ਸਾਡੇ ਇਲਾਕੇ ਦੇ ਵਿੱਚ ਸਭ ਤੋਂ ਵੱਖਰੀ ਰਸਮ ਇੱਕ ਨਾੜੂਆ ਦੱਬਣ ਦੀ ਕੀਤੀ ਜਾਂਦੀ ਹੈ ਅਤੇ ਬੱਚਾ ਇਹਦਾ ਨਾੜੂਆ ਜਦ ਉਤਰਦਾ ਨਾ ਉਸ ਨਾਲ ਕੀ ਹੈ ਜਦ ਵੀ ਪਹਿਲੀ ਓਲ਼ ਹੁੰਦੀ ਹੈ ਬੱਚੇ ਦੀ ਔਰ ਓਲ਼ ਨੂੰ ਵੀ ਇੱਕ ਨਾ ਕਿਸੇ ਵੀ ਕਮਰੇ ਜਾਂ ਕਿਸੇ ਆਪਣੇ ਘਰ ਦੇ ਮਤਲਬ ਬਾਉਂਡਰੀ ਦੇ ਵਿੱਚ ਹੀ ਨਾ ਉਹਨੂੰ ਦਬਾ ਕੇ ਉਹਦੇ ਪਰ ਪੈਸੇ ਪਾ ਕੇ ਦੱਬ ਦਿੱਤਾ ਜਾਂਦਾ ਹੈ ਅਤੇ ਉਹ ਜਦੋਂ ਵੀ ਬੱਚਾ ਰੋਂਦਾ ਹੈ ਅਤੇ ਉਹਦੇ ਉੱਤੇ ਜਾ ਕੇ ਦੋ ਤਿੰਨ ਵਾਰੀ ਥੱਪੀਆਂ ਮਾਰੀਆਂ ਜਾਂਦੀਆਂ ਹਨ ਇੱਕ ਇਹ ਕਿ ਆਮ ਰਿਵਾਜ ਹੈ ਕਿ ਜੇਕਰ ਬੱਚਾ ਰੋਂਦਾ ਹੋਵੇ ਜਾਂ ਬਿਮਾਰ ਹੋ ਜਾਵੇ ਤਾਂ ਉਸ ਦੇ ਉੱਤੇ ਜਾ ਕੇ ਥੱਪੀ ਮਾਰ ਦੇਵੋ ਔਰ ਦੂਜੀ ਰਸਮ ਹੈ ਨਾੜੂਆ ਨਾੜੂਆ ਵੀ ਕਿਸੇ ਦੀ ਔਰਤ ਦੇ ਗਲ਼ ਵਿੱਚ ਪਾ ਦੇਵੋ ਤਾਂ ਉਹ ਜਿਹੜੀ ਬਾਂਝ ਔਰਤ ਹੈਗੀ ਉਹ ਮਾਂ ਬਣ ਜਾਂਦੀ ਹੈਗੀ ਅਤੇ ਜੇਕਰ ਬੱਚੇ ਦੀ ਜੇ ਇਸ ਨਾੜੂਏ ਨੂੰ ਇੰਨਾ ਸੰਭਾਲ ਕੇ ਰੱਖਿਆ ਜਾਂਦਾ ਹੈ ਕਿ ਕਿਸੇ ਦੀ ਵੀ ਨਜ਼ਰ ਨਹੀਂ ਪਾਈ ਜਾਂਦੀ ਇਹ ਕਿਤੇ ਮਤਲਬ ਇਹਨੂੰ ਜਦੋਂ ਕੋਈ ਬੱਚਾ ਵਿਆਹਿਆ ਨਹੀਂ ਜਾਂਦਾ ਹੈਗਾ ਉਹ ਤਾਂ ਫਿਰ ਸੰਭਾਲ਼ ਕੇ ਰੱਖਣ ਦੀ ਇੱਕ ਰਸਮ ਕੀਤੀ ਜਾਂਦੀ ਹੈ